ਡਾਂਸ ਕਰਨਾ ਮੇਰੀ ਛੋਟੇ ਹੁੰਦੇ ਦੀ ਹੀ ਹੋਬੀ ਹੈ ਮੇਰੇ ਮੰਮਾ ਡਾਂਸ ਟੀਚਰ ਸਨ ਮੈਨੂੰ ਅੱਜ ਵੀ ਯਾਦ ਹੈ ਜਦੋਂ ਥਰਡ ਕਲਾਸ ਵਿੱਚ ਹੁੰਦਾ ਸੀ ਤਾਂ ਮੈਂ ਦੋਸਤਾਂ ਨੂੰ ਮੈਨੂੰ ਡਾਂਸ ਕਰਨ ਲਈ ਮੋਟੀਵੇਟ ਕਰਿਆ ਕਿਉਂਕਿ ਮੇਰੇ ਅੰਦਰ ਡਾਂਸ ਕਰਨ ਦੀ ਕਲਾ ਗੋਡ ਗਿਫਟਡ ਹੈ ਅਤੇ ਬਾਕੀ ਮੇਰੇ ਮੰਮਾ ਡਾਂਸ ਟੀਚਰ ਹੋਣ ਕਰਕੇ ਉਹਨਾਂ ਕੋਲ ਬੱਚੇ ਘਰ ਵਿੱਚ ਡਾਂਸ ਸਿੱਖਣ ਲਈ ਆਉਂਦੇ ਸਨ ਅਤੇ ਮੇਰਾ ਦਿਲ ਵੀ ਉਨਾਂ ਨੂੰ ਦੇਖ ਕੇ ਨੱਚਣ ਨੂੰ ਕਰਦਾ ਤਾਂ ਮੇਰੇ ਮੰਮਾ ਨੇ ਮੈਨੂੰ ਬੱਚਿਆਂ ਦੇ ਨਾਲ ਹੀ ਡਾਂਸ ਦੀ ਪ੍ਰੈਕਟਿਸ ਕਰਵਾ ਦਿੰਦੇ ਸੀ ਅਤੇ ਮੈਂ ਉਦੋਂ ਫਸਟ ਪੋਜੀਸ਼ਨ ਹਾਸਲ ਕੀਤੀ ਸੀ ਅਤੇ ਅੱਜ ਮੈਂ ਵੀ ਇੱਕ ਸਕੂਲ ਵਿੱਚ ਮਿਊਜ਼ਿਕ ਟੀਚਰ ਹਾਂ ਅਤੇ ਮੇਰਾ ਇੱਕ ਬੇਟਾ ਵੀ ਹੈ ਉਹ ਵੀ ਮੈਨੂੰ ਦੇਖ ਕੇ ਆਪਣਾ ਇੰਟਰਸਟ ਡਾਂਸ ਵਿੱਚ ਬਣਾ ਰਿਹਾ ਹੈ ਇਸ ਤਰ੍ਹਾਂ ਹੀ ਮੈਂ ਆਪਣੇ ਪਹਿਲੇ ਡਾਂਸ ਵਿੱਚ ਭਾਗ ਲਿਆ ਸੀ